ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੌਣ ਬੋਲਦਾ ਹਾਂਜੀ ਹਾਂਜੀ ਹਾਂਜੀ ਮੈਮ ਕਰਵਾਉਦੇ ਆ ਮੈਮ ਡਾਸਿੰਗ ਸਿੰਗਿੰਗ ਹੋਰ ਸਵੀਮਿੰਗ ਹਾਂਜੀ ਮੈਮ ਹਾਂਜੀ ਸਿਖਾਉਂਦੇ ਆ ਮੈਮ ਐਕਸਸਾਈਜ਼ ਵਗੈਰਾ ਕਰਵਾਉਂਦੇ ਆ ਬੱਚਿਆਂ ਨੂੰ ਸਵੀਮਿੰਗ ਵੀ ਕਰਵਾਉਂਦੇ ਆ ਹਾਂਜੀ ਹਾਂਜੀ ਮੈਮ ਵਧੀਆ ਆ ਵਧੀਆ ਟੀਚਰ ਵਗੈਰਾ ਟ੍ਰੇਨਿੰਗ ਦਿੰਦੇ ਬੱਚਿਆਂ ਨੂੰ ਹਾਂਜੀ ਜਿਸ ਵੇਲੇ ਤੇਰਾ ਕੋਰਸ ਕੰਪਲੀਟ ਹੋ ਜਾਏਗਾ ਫਿਰ ਉਹਦੀ ਪਰਫੋਰਮੈਂਸ ਹੋਣੀ ਆ ਵਧੀਆ ਹੋਏਗੀ ਤੁਹਾਨੂੰ ਫਿਰ ਸਰਟੀਫਿਕੇਟ ਦਿੱਤਾ ਜਾਏਗਾ ਤੇ ਇਸਤੇ ਮੈਮ ਹੋਏਗੀ ਫਾਈਵ ਥਾਊਜੈਂਟ ਤੱਕ ਹਾਂਜੀ ਹਾਂਜੀ ਮੈਡਲ ਦਿੱਤੇ ਜਾਣਗੇ ਕਰਾਵਾਂਗੇ ਵਧੀਆ ਹੋਏਗਾ ਹੁਣ ਮੈਡਲ ਦਿੱਤੇ ਜਾਣਗੇ ਸਰਟੀਫਿਕੇਟ ਦਿੱਤਾ ਜਾਏਗਾ ਜੋ ਉਹਨਾਂ ਨੇ ਬੜੇ ਜਿਆਦਾ ਕੰਮ ਆਏਗਾ ਹਾਂਜੀ ਹਾਂਜੀ ਮੈਮ ਕਰਵਾਉਂਦੇ ਆ ਤੁਸੀਂ ਆਪਣੇ ਬੱਚੇ ਦਾ ਕਰਵਾਉਣਾ ਐ ਐਡਮਿਸ਼ਨ ਸਾਡੀ ਅਕੈਡਮੀ 'ਚ ਤੋ ਫਿਰ ਮੈਮ ਤੁਸੀਂ ਜਲਦੀ ਤੋਂ ਜਲਦੀ ਪਵਾ ਲਓ ਮੈਮ ਫੋਮ ਆਧਾਰ ਕਾਰਡ ਆਧਾਰ ਕਾਰਡ ਚਹੀਦਾ ਐਡਵਾਂਸ ਵੀ ਥੋੜਾ ਜਿਹਾ ਪੇ ਕਰਨਾ ਪਏਗਾ ਹਾਂ ਮੈਮ ਮੈਂ ਥੋਨੂੰ ਲਿਸਟ ਬਣਾ ਕੇ ਸੈਂਡ ਕਰਦਾਂਗੀ ਜੋ ਸਾਰੇ ਡੋਕੂਮੈਂਟ ਚਾਹੀਦੇ ਆ ਐਡਵਾਂਸ ਵੀ ਜਿੱਦਾਂ ਉਹਦਾ ਪੂਰਾ ਫਾਈਵ ਥਾਊਜੈਂਟ ਆ ਥੋਨੂੰ ਟੂ ਫਿਫਟੀ ਥਾਊਜੈਂਟ ਕਰਨਾ ਪਏਗਾ ਹਾਫ ਉਹਦਾ ਹਾਂਜੀ ਮੈਮ ਹਾਂਜੀ ਹਾਂਜੀ ਠੀਕ ਹੈ ਮੈਮ ਠੀਕ ਹੈ